ਸਾਨੂੰ ਚਿੱਤਰਕਾਰੀ ਤੋਂ ਬਹੁਤ ਜ਼ਿਆਦੇ ਲਾਭ ਹੁੰਦੇ ਨੇ ਜਿਵੇਂ ਕਿ ਆਪਾਂ ਇੱਥੋਂ ਇਨਕਮ ਕਰ ਸਕਦੇ ਹਾਂ ਜਿੰਨੀ ਤੁਹਾਨੂੰ ਪ੍ਰੈਕਟਿਸ ਹੈਗੀ ਹੈ ਆਪਣੀ ਚਿੱਤਰਕਾਰੀ ਦੀ ਉਹਦੇ ਹਿਸਾਬ ਨਾਲ਼ ਤੁਸੀਂ ਇਨਕਮ ਜਿਹੜੀ ਕਿ ਆਪਣੀ ਕਰ ਸਕਦੇ ਹੋ ਅਤੇ ਇਸ ਤੋਂ ਜਿੱਦਾਂ ਮੇਰੇ ਟੀਚਰ ਨੇ ਮੈਨੂੰ ਸਿਖਾਇਆ ਹੈ ਉਹਨਾਂ ਨੇ ਅਲੱਗ ਅਲੱਗ ਮੈਨੂੰ ਬਰੀਕੀਆਂ ਜਿਹੜੀਆਂ ਕਿ ਸਿਖਾਈਆਂ ਨੇ ਹਰੇਕ ਚੀਜ਼ ਦੀ ਬਰੀਕੀ ਸਿਖਾਈ ਹੈ ਕਿੱਦਾਂ ਬਰੱਸ਼ ਨੂੰ ਫ ਫੜਨਾ ਆਂ ਅਤੇ ਕਿੱਦਾਂ ਪੇਂਟਿੰਗ ਮੀਨਸ ਕਿ ਕਿਹੜੀ ਚੀਜ਼ 'ਤੇ ਕਿਵੇਂ ਪੇਂਟਿੰਗ ਕਰਨੀ ਹੈ ਕਿੱਦਾਂ ਕਲਰਸ ਦੇ ਸਾਰੇ ਉਹਨਾਂ ਨੇ ਮੈਨੂੰ ਦੱਸਿਆ ਹੈ ਉਹਦੇ ਬਾਰੇ ਅਤੇ ਕਈ ਪੇਂਟਿੰਗਸ 'ਚ ਆਪਾਂ ਅਲੱਗ ਅਲੱਗ ਤਰ੍ਹਾਂ ਦੇ ਮੀਨਸ ਲੋਕਾਂ ਲਈ ਲੋਕਾਂ ਨੂੰ ਅਟਰੈਕਟ ਕਰਨ ਲਈ ਆਪਾਂ ਬਹੁਤ ਕੁਝ ਇੱਦਾਂ ਦੀ ਚਿੱਤਰਕਾਰੀ ਕਰ ਸਕਦੇ ਹਾਂ ਜਿਹਦੇ ਨਾਲ਼ ਉਹਨਾਂ ਨੂੰ ਸਿੱਖਿਆ ਵੀ ਮਿਲੇ ਅਤੇ ਉਹ ਚਿੱਤਰਕਾਰੀ ਦਾ ਵੀ ਆਪਾਂ ਨੂੰ ਲਾਭ ਹੋਵੇ ਅਤੇ ਲੋਕਾਂ ਨੂੰ ਵੀ ਲਾਭ ਹੋਵੇ ਅਤੇ ਜਿਹੜੀਆਂ ਕਈ ਚਿੱਤਰਕਾਰੀਆਂ ਹੁੰਦੀਆਂ ਨੇ ਵਧੀਆ ਵਧੀਆ ਅਤੇ ਲੋਕ ਉਹਨਾਂ ਨੂੰ ਆਪਣੇ ਘਰ ਦੇ ਦੀਵਾਰਾਂ 'ਤੇ ਵੀ ਲਗਾਉਂਦੇ ਨੇ ਅਤੇ ਜਿਹਦੇ ਨਾਲ਼ ਉਹਨਾਂ ਦੇ ਘਰ ਦੀ ਅਤੇ ਉਹਨਾਂ ਦੀ ਦੀਵਾਰਾਂ ਦੀ ਖੂਬਸੂਰਤੀ ਬਣਦੀ ਹੈ ਅਤੇ ਜਦੋਂ ਉਹਨਾਂ ਦੇ ਘਰ ਮਹਿਮਾਨ ਆਉਂਦੇ ਹ ਨੇ ਅਤੇ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਅਟਰੈਕਟ ਕਰਦੀਆਂ ਨੇ ਜਿਹੜੀਆਂ ਕਿ ਪੇਂਟਿੰਗਸ ਜਾਂ ਚਿੱਤਰਕਾਰੀ ਜੋ ਵੀ ਆਪਾਂ ਲਗਾਉਂਦੇ ਨੇ ਆਪਣੇ ਘਰਾਂ 'ਤੇ ਉਸ ਨਾਲ਼ ਆਪਣੇ ਘਰ ਦੀ ਖੂਬਸੂਰਤੀ ਵੀ ਵੱਧਦੀ ਹੈ ਅਤੇ ਆਪਾਂ ਨੂੰ ਬਹੁਤ ਚੰਗਾ ਲੱਗਦਾ ਹੈ ਅਤੇ ਉਹਨਾਂ ਨੂੰ ਵੀ ਚੰਗਾ ਲੱਗਦਾ ਹੈ